ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਤਿੰਨ ਮਾਰਚ ਉੱਨੀ ਸੋ ਬਾਹਠ ਚੌਦਾਂ ਫਰਵਰੀ ਉੱਨੀ ਸੌ ਪੈਂਹਠ ਅੱਠ ਜੂਨ ਉੱਨੀ ਸੌ ਛਿਆਸੀ ਪੰਜ ਸਤੰਬਰ ਉੱਨੀ ਸੌ ਅਠਾਸੀ